ਮੈਂ ਭਾਰਤ ਵਿੱਚ ਪ੍ਰਾਚੀਨ ਅਤੇ ਮੱਧਕਾਲੀ ਦੌਰ ਦੇ ਰਾਜਿਆਂ ਦੀ ਗੱਲ ਕਰਾਂ ਤਾਂ ਤਿੰਨ ਰਾਜਿਆਂ ਦੇ ਨਾਮ ਜਿਹੜੇ ਨੇ ਉਹ ਮੇਰੇ ਜ਼ਹਿਨ ਵਿੱਚ ਬਹੁਤ ਚੰਗੀ ਤਰ੍ਹਾਂ ਛਪੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੇ ਨੇ ਸਾਡੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਅਤੇ ਰਾਣਾ ਪ੍ਰਤਾਪ ਨਾਮ ਦੇ ਇੱਕ ਰਾਠੌਰੀ ਰਾਜਾ ਜਿਨ੍ਹਾਂ ਦੇ ਬਾਰੇ ਮੈਂ ਇੱਕ ਸੀਰੀਅਲ ਵੀ ਦੇਖਿਆ ਸੀ ਅਤੇ ਇਹਨਾਂ ਦੇ ਬਾਰੇ ਮੈਂ ਬਹੁਤ ਵਾਰ ਪੜ੍ਹਿਆ ਵੀ ਹੈ ਆਪਣੀਆਂ ਕੁਛ ਕਿਤਾਬਾਂ ਦੇ ਵਿੱਚ ਮੇਰੇ ਜ਼ਹਿਨ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਇੱਕ ਕਹਾਣੀ ਜਿਹੜੀ ਹੈ ਉਹ ਵਸੀ ਹੋਈ ਹੈ ਜੋ ਮੈਨੂੰ ਇੱਕ ਗਾਣੇ ਦੇ ਦੁਆਰਾ ਪਤਾ ਲੱਗੀ ਸੀ ਤਾਂ ਅਰਜਨ ਢਿੱਲੋ ਇੱਕ ਗਾਇਕ ਨੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਇੱਕ ਗਾਣਾ ਹੈ ਮਹਾਰਾਣੀ ਜਿੰਦਾ ਜੋ ਦਲੀਪ ਸਿੰਘ ਦੀ ਮਾਂ ਸੀ ਅਤੇ ਉਸ ਗਾਣੇ ਦੇ ਅੰਦਰ ਉਹਨਾਂ ਨੇ ਉਹਨਾਂ ਦੇ ਮਾਂ ਦੇ ਨਾਲ ਮਿਲਾਪ ਦੇ ਬਾਰੇ ਵਰਣਨ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਕੈਦ ਕਰਕੇ ਲੈ ਜਾਂਦੇ ਨੇ ਅਤੇ ਉਹਨਾਂ ਨੂੰ ਅੰਗਰੇਜ਼ ਬਣਾ ਦਿੰਦੇ ਨੇ ਉਹਨਾਂ ਦੇ ਕੇਸ ਕੱਟ ਦਿੰਦੇ ਨੇ ਅਤੇ ਜਦ ਆਪਣੀ ਮਾਂ ਨੂੰ ਮਿਲਦੇ ਨੇ ਤਾਂ ਉਹਨਾਂ ਦੀ ਜਿਹੜੀ ਮਾਂ ਹੈ ਉਹ ਆਪਣੇ ਅੱਖਾਂ ਦੀ ਰੌਸ਼ਨੀ ਖੋ ਚੁੱਕੀ ਹੁੰਦੀ ਹੈ ਅਤੇ ਉਹ ਕਿਸ ਤਰੀਕੇ ਨਾਲ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਨੇ ਉਸ ਵਕਤ ਇਹ ਆਪਣੇ ਬੇਟੇ ਦੇ ਵਾਲਾਂ ਨੂੰ ਕੇਸਾਂ ਨੂੰ ਹੱਥ ਲਾਉਂਦੇ ਨੇ ਤਾਂ ਅਨੁਭਵ ਕਰਦੇ ਨੇ ਕਿ ਉਹ ਕੱਟੇ ਹੋਏ ਨੇ ਅਤੇ ਉਹਨਾਂ ਦਾ ਜਿਹੜਾ ਬੇਟਾ ਮਹਾਰਾਜਾ ਸੀ ਜਿਹੜਾ ਸ਼ਾਹ ਸੀ ਸਰਦਾਰ ਸੀ ਜਾਂ ਕਹਿ ਲਉ ਇੱਕ ਹਕੂਮਤ ਦਾ ਹੈਡ ਸੀ ਉਹ ਹੁਣ ਉਸ ਤਰੀਕੇ ਦਾ ਨਹੀਂ ਰਿਹਾ ਅਤੇ ਕਿਹਾ ਜਾਂਦਾ ਹੈ ਕਿ ਜਦ ਉਹ ਉਹਨਾਂ ਨੂੰ ਮਿਲੇ ਬਹੁਤ ਸਾਲਾਂ ਬਾਅਦ ਤਾਂ ਉਹ ਜਿਹੜਾ ਦ੍ਰਿਸ਼ ਸੀ ਉਹ ਬਹੁਤ ਜ਼ਿਆਦਾ ਆਕਰਸ਼ਿਤ ਸੀ ਅਤੇ ਇਹਨਾਂ ਬਾਰੇ ਕਈ ਕਿਤਾਬਾਂ ਵਿੱਚ ਵੀ ਲਿਖਿਆ ਗਿਆ ਹੈ ਅਤੇ ਭਾਰਤੀ ਇਤਿਹਾਸ ਬਾਰੇ ਜੇਕਰ ਕੋਈ ਆਕਰਸ਼ਿਤ ਕਰਨ ਵਾਲੀ ਗੱਲ ਦੇ ਬਾਰੇ ਮੈਂ ਗੱਲ ਕਰਾਂ ਤਾਂ ਉਹ ਇਹ ਹੈ ਕਿ ਜਦ ਵੀ ਮੈਂ ਕਿਸੇ ਮਹਾਰਾਜੇ ਦੇ ਬਾਰੇ ਖਾਸਕਰ ਪੰਜਾਬ ਦੇ ਰਾਜਿਆਂ ਬਾਰੇ ਪੜ੍ਹਦੀ ਹਾਂ ਤਾਂ ਬਹੁਤ ਜ਼ਿਆਦਾ ਚੜ੍ਹਦੀ ਕਲਾ ਦੇ ਬਾਰੇ ਸਿੱਖਣ ਨੂੰ ਮਿਲਦਾ ਹੈ ਸਾਨੂੰ ਚਾਹੇ ਉਹ ਕਿਸੇ ਵੀ ਤਰੀਕੇ ਦੀ ਕੋਈ ਵੀ ਮੁਸੀਬਤ ਹੋਵੇ ਉਸ ਤੋਂ ਇਲਾਵਾ ਮੈਂ ਇੱਕ ਵਾਰ ਪੜ੍ਹਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਇੱਕ ਅਜਿਹੇ ਰਾਜੇ ਸੀ ਵੀ ਜਿਨ੍ਹਾਂ ਦੇ ਰਾਜ ਵਿੱਚ ਜੇਲਾਂ ਨਹੀਂ ਸੀ ਹੁੰਦੀਆਂ ਤਾਂ ਮਤਲਬ ਕਿ ਉਹ ਉਹਨਾਂ ਦੇ ਵੇਲੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੱਚ ਦੀ ਭਾਵਨਾ ਹੁੰਦੀ ਸੀ ਜਿਹੜੇ ਕ੍ਰਾਈਮਸ ਨੇ ਬਹੁਤ ਘੱਟ ਜਾਂ ਹੁੰਦੇ ਹੀ ਨਹੀਂ ਸੀ ਅਤੇ ਉਹਨਾਂ ਦੇ ਰਾਜ 'ਚ ਜੇਲਾਂ ਨਹੀਂ ਸੀ ਤਾਂ ਇਹ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿ ਐਸਾ ਵੀ ਵਕਤ ਸੀਗਾ ਅਤੇ ਦਿਲ ਦੇ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਕਦੇ ਨਾ ਕਦੇ ਐਸਾ ਵਕਤ ਵੀ ਅ ਵੀ ਵਾਪਸ ਆਵੇ ਕਿਉਂਕਿ ਜਿਹੜਾ ਅੱਜ ਦਾ ਦੌਰ ਹੈ ਉਸ ਤੋਂ ਕਿਤੇ ਹੀ ਉਲਟ ਹੋ ਗਿਆ ਅਤੇ ਸਾਨੂੰ ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜੋ ਸ ਸਾਡੇ ਦਿਲ ਨੂੰ ਦੁਖੀ ਕਰ ਦਿੰਦੀਆਂ ਨੇ